ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਿੰਕੀ ਹੈ ਇਸਲਾਮਾਬਾਦ ਮੁਹੱਲੇ ਤੋਂ ਬੋਲਦੀ ਪਈ ਹਾਂ ਅਸੀਂ ਨਾ ਇੱਥੇ ਟੂਰਿਸਟ ਆਏ ਹੋਏ ਸੀ ਇੱਥੇ ਪਾਰਕ ਮਤਲਬ ਕਿ ਕਿਹੜੀ ਕਿਹੜੀ ਵਧੀਆ ਹੈ ਜਿਵੇਂ ਪਾਰਕ ਵਗੈਰਾ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ